ਭਾਰਤ ਵਿੱਚ ਬੰਗਲੌਰ ਤੋਂ ਇਲਾਵਾ ਪਹਿਲਾਂ ਕੋਈ ਵੀ ਪ੍ਰਾਂਤ ਆਈਟੀ ਖੇਤਰ ਲਈ ਮਸ਼ਹੂਰ ਨਹੀਂ ਸੀ ਪਰ ਹੁਣ ਜਿਵੇਂ ਜਿਵੇਂ ਤਕਨੋਲਜੀ ਵਿੱਚ ਤਰੱਕੀ ਆ ਰਹੀ ਹੈ ਹੁਣ ਪੰਜਾਬ ਵੀ ਉਸ ਵਿੱਚ ਸ਼ਾਮਿਲ ਹੋ ਰਿਹਾ ਹੈ ਰਾਜ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਅਨੁਸਾਰ ਪੰਜਾਬ ਵਿੱਚ ਆਈਟੀ ਅਤੇ ਸਟਾਰਟ ਅਪ ਸੈਕਟਰ ਲਈ ਸਭ ਤੋਂ ਵਧੀਆ ਇਕੋ ਸਿਸਟਮ ਹੈ ਅਤੇ ਇਹ ਬੇਅੰਤ ਮੌਕੇ ਪ੍ਰਦਾਨ ਕਰਦਾ ਹੈ ਰਾਜ ਸ਼ਾਸਕੀ ਸੁਧਾਰ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਰੱਖਿਆ ਹੈ ਕਿ ਉਦਯੋਗ ਨੀਤੀਗਤ ਫੈਸਲਿਆਂ ਵਿੱਚ ਆਈਟੀ ਸੈਕਟਰ ਦੀ ਵੀ ਬਰਾਬਰ ਦੀ ਭਾਈ ਵਾਲੀ ਹੋਵੇ ਪੰਜਾਬ ਹੁਣ ਬੇਅੰਤ ਮੌਕਿਆਂ ਦੀ ਧਰਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਉਮੀਦ ਦਿੱਤੀ ਹੈ ਕਿ ਪੰਜਾਬ ਨੂੰ ਇੱਕ ਉਦਯੋਗਿਕ ਅਤੇ ਆਈਟੀ ਹੱਬ ਵਿੱਚ ਬਦਲ ਕੇ ਆਰਥਿਕ ਵਿਕਾਸ ਦੇ ਉੱਚ ਵਿਕਾਸ ਦੇ ਪੰਧ ਉੱਤੇ ਲਿਆਂਦਾ ਜਾ ਸਕਦਾ ਹੈ ਮੁੱਖ ਮੰਤਰੀ ਨੇ ਇੱਥੇ ਦੂਜੇ ਅਤੇ ਸਮਾਪਤੀ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 'ਤੇ ਇਹ ਬਿਆਨ ਦਿੱਤਾ ਇੱਕ ਸੈਸ਼ਨ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਇਸ ਸਮੇਂ ਇੱਕ ਸੌ ਪੰਜਾਹ ਤੋਂ ਵੱਧ ਰਜਿਸਟਰਡ ਆਈਟੀ ਯੂਨਿਟ ਕੰਮ ਕਰ ਰਹੇ ਹਨ ਜਿਹਨਾਂ ਵਿੱਚ ਲਗਭਗ ਪੈਂਤੀ ਹਜ਼ਾਰ ਦੇ ਕਰੀਬ ਆਈਟੀ ਪੇਸ਼ੇਵਰ ਕੰਮ ਕਰ ਰਹੇ ਹਨ ਮੋਹਾਲੀ ਜੋ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਿਹਾ ਹੈ ਤੇਜ਼ੀ ਨਾਲ ਆਈਟੀ ਹੱਬ ਵਜੋਂ ਵਿਕਸਿਤ ਹੋ ਰਿਹਾ ਹੈ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਇਸ ਦੀ ਇੱਕ ਰਣਨੀਤਕ ਸਥਿਤੀ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਹੈ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਅੱਠ ਸੌ ਤੋਂ ਵੱਧ ਸਟਾਰਟ ਅਪ ਹਨ ਜਿਹਨਾਂ ਵਿੱਚ ਦੋ ਸੌ ਤੋਂ ਢਾਈ ਸੌ ਦੇ ਵਿੱਚ ਵਿੱਚ ਆਈਟੀ ਖੇਤਰ ਨਾਲ ਸੰਬੰਧਿਤ ਹਨ ਅਤੇ ਵੀਹ ਤੋਂ ਵੱਧ ਸਰਕਾਰੀ ਫੰਡ ਪ੍ਰਾਪਤ ਅਤੇ ਨਿੱਜੀ ਇਨਕਿਊਬੇਟਰ ਅਤੇ ਐਕਸਲਰੇਟਰ ਸ਼ਾਮਿਲ ਹਨ ਇਸ ਤੋਂ ਪਹਿਲਾਂ ਸਕੱਤਰ ਪ੍ਰਸ਼ਾਸਕੀ ਸੁਧਾਰ ਤੇਜਵੀਰ ਸਿੰਘ ਨੇ ਰਾਜ ਵਿੱਚ ਨਿਵੇਸ਼ ਦੀ ਸੰਭਾਵਨਾ ਨੂੰ ਉਜਾਗਰ ਕੀਤਾ ਨੈਟ ਸਲਿਊਸ਼ਨਸ ਦੇ ਸੰਸਥਾਪਕ ਅਤੇ ਸੀਈਓ ਸਮੀਰ ਜੈਨ ਨੇ ਸੈਸ਼ਨ ਦੀ ਸ਼ੁਰੂਆਤ ਵਿੱਚ ਨਾ ਸਿਰਫ ਮੌਜੂਦਾ ਸਗੋਂ ਭਵਿੱਖ ਦੀਆਂ ਆਈਟੀ ਨਾਲ ਜੁੜੀ ਮੰਗਾਂ ਨੂੰ ਪੂਰਾ ਕਰਨ ਲਈ ਹੁਨਰ ਵਿਕਸਿਤ ਕਰਨ ਦੀ ਲੋੜ 'ਤੇ ਜ਼ੋਰ ਦੇ ਕੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਰਾਜ ਦੇ ਵਿਦਿਅਕ ਅਦਾਰਿਆਂ ਨੂੰ ਡਿਜੀਟਲ ਮਾਰਕੀਟਿੰਗ ਦੇ ਹੁਨਰ ਪ੍ਰਧਾਨ ਕਰਨ ਅਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਇੱਥੇ ਦੋ ਰੋਜ਼ਾ ਸਮਾਗਮ ਦੇ ਉਦਘਾਟਨੀ ਸੈਸ਼ਨ ਦੌਰਾਨ ਵਪਾਰਕ ਆਗੂਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚ ਆਈਟੀ ਉਦਯੋਗ ਲਈ ਸਭ ਤੋਂ ਅਨੁਕੂਲ ਨਿਵੇਸ਼ ਅਸਥਾਨ ਬਣਨ ਜਾ ਰਿਹਾ ਹੈ ਅਤੇ ਨਿਵੇਸ਼ਕਾਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਧੰਨਵਾਦ